ਛੱਬੀ ਜੁਲਾਈ ਦੋ ਹਜ਼ਾਰ ਦੋ ਪੱਚੀ ਜੁਲਾਈ ਉੱਨੀ ਸੋ ਬਹੱਤਰ ਪੰਜ ਜੁਲਾਈ ਉੱਨੀ ਸੌ ਪਝੱਤਰ ਬਾਰ੍ਹਾਂ ਅਗਸਤ ਉੱਨੀ ਸੌ ਨੜ੍ਹਿਨਵੇਂ ਇੱਕ ਜਨਵਰੀ ਦੋ ਹਜ਼ਾਰ ਇੱਕੀ